ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਕੁੜੀਆਂ ਅਤੇ ਮੁੰਡੇ ਆਪਣਾ ਵੱਖਰਾ ਵੱਖਰਾ ਪਹਿਰਾਵਾ ਪਹਿਨਦੀਆਂ ਹਨ ਜਿਵੇਂ ਕਿ ਪੰਜਾਬੀ ਮੁੰਡੇ ਆ ਜੋ ਉਹ ਚਾਦਰਾ ਕੁੜਤਾ ਅਤੇ ਗਲੇ ਵਿੱਚ ਕੈਂਠਾ ਅਤੇ ਤੁਰਲੇ ਵਾਲੀ ਪੱਗ ਬੰਨ੍ਹਦੇ ਹਨ ਅਤੇ ਪੈਰਾਂ ਵਿੱਚ ਪੰਜਾਬੀ ਜੁੱਤੀ ਪਾਉਂਦੇ ਹਨ ਅਤੇ ਕੁੜੀਆਂ ਸਲਵਾਰ ਸੂਟ ਪਾਉਂਦੀਆਂ ਹਨ ਅਤੇ ਉਹ ਪੰਜਾਬੀ ਜੁੱਤੀ ਪਾਉਂਦੀਆਂ ਹਨ ਅਤੇ ਉਹ ਪਰਾਂਦਾ ਲਗਾਉਂਦੀਆਂ ਹਨ ਅਤੇ ਉਹਨਾਂ ਦੀਆਂ ਇਹ ਜਿਹੜੀਆਂ ਰੰਗ ਬਿਰੰਗੀਆਂ ਪੋਸ਼ਾਕਾਂ ਆ ਉਹ ਉਹਨਾਂ ਦੀ ਜਿਹੜੀ ਪੋਸ਼ਾਕ ਆ ਉਹ ਡਾਂਸ ਕਰਨ ਵਾਲੇ ਵਾਲਿਆਂ ਨੂੰ ਅ ਆਕਰਸ਼ਕ ਬਣਾਉਂਦੀ ਆ ਕਿਉਂਕਿ ਉਹਨਾਂ ਦੀਆਂ ਪੋਸ਼ਾਕਾਂ ਜਿਹੜੀਆਂ ਨਾ ਉਹ ਦੂਸਰਿਆਂ ਨੂੰ ਵੀ ਮਨਮੋਹਿਤ ਕਰਦੀਆਂ ਹਨ ਅਤੇ ਉਹਨਾਂ ਦੀਆਂ ਜਿਹੜੀਆਂ